ਮੈਂ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹਾਂ ਪਟਿਆਲੇ ਵਿੱਚ ਕਈ ਅਪਰਾਧ ਅਤੇ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਜਿਵੇਂ ਕਿ ਇਹਨਾਂ 'ਤੇ ਕੰਟਰੋਲ ਪਾਉਣ ਲਈ ਸਰਕਾਰ ਨੇ ਬਹੁਤ ਸਾਰੇ ਯਤਨ ਕੀਤੇ ਹਨ ਪੁਲਿਸ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੀ ਟ੍ਰੈਫਿਕ ਰੂਲਸ ਬਣਾਏ ਹਨ ਜੋ ਕਿ ਟ੍ਰੈਫਿਕ ਲਾਈਟਸ ਅਤੇ ਕੈਮਰੇ ਲਗਾਏ ਗਏ ਹਨ ਜਿਸ ਵਿੱਚ ਕਾ ਓਹ ਕੋਈ ਵੀ ਓਵਰ ਸਪੀਡ ਵਾਹਨ ਆ ਰਿਹਾ ਹੈ ਤਾਂ ਕੈਮਰੇ ਵਿੱਚ ਰਿਕੋਰਡ ਹੋ ਜਾਂਦਾ ਹੈ ਜੇਕਰ ਉਹਦਾ ਫਿਰ ਚਲਾਨ ਵੀ ਕੱਟਿਆ ਜਾਂਦਾ ਹੈ ਤਾਂ ਕਰਕੇ ਇਹ ਇਹ ਅਪਰਾਧਾਂ ਨੂੰ ਰੋਕਣ ਲਈ ਵੀ ਕਈ ਕਈ ਥਾਵਾਂ 'ਤੇ ਭੀੜ ਭੜੱਕੇ ਵਾਲੀਆਂ ਜਗ੍ਹਾ 'ਤੇ ਕੈਮਰੇ ਲਗਾਏ ਗਏ ਹਨ ਤਾਂ ਕਿ ਹੋਰ ਲੋਕਾਂ ਦੀ ਵੀ ਸੁਰੱਖਿਆ ਹੋ ਸਕੇ ਲੋਕ ਅਪਰਾਧਾਂ ਅਤੇ ਦੁਰਘਟਨਾਵਾਂ ਤੋਂ ਬੱਚ ਸਕਣ ਤ ਸਰਕਾਰ ਬਹੁਤ ਹੀ ਵਧੀਆ ਇਹ ਯਤਨ ਸੁਧਾਰ ਕਰ ਰਹੀ ਹੈ ਮੈਂ ਆਸ਼ਾ ਕਰਦੀ ਹਾਂ ਕਿ ਸਰਕਾਰ ਅੱਗੇ ਵੀ ਇਸ ਤੋਂ ਵਧੀਆ ਹੋਰ ਸੁਧਾਰ ਕਰਨ ਦੀ ਲੋੜ ਹੈ